ਜਿੱਥੇ ਅਸੀਂ ਰਹਿੰਦੇ ਹਾਂ ਪਿੰਡ ਦੇ ਆਲੇ ਦੁਆਲੇ ਕਾਫੀ ਨਜ਼ਦੀਕ ਜੰਗਲ ਬਹੁਤ ਪਹਾੜੀਆਂ ਹਨ ਉੱਥੇ ਲੋਕ ਇੱਕ ਡੈਮ ਵੀ ਹੈ ਉਹਨੂੰ ਲੋਕ ਦੇਖਣ ਜਾਂਦੇ ਨੇ ਅਤੇ ਇੱਕ ਬਹੁਤ ਵੱਡਾ ਡੈਮ ਹੈ ਉਥੇ ਵੀ ਪਾਰਕਿੰਗ ਬਣੀ ਹੋਈ ਹੈ ਉਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਹਨ ਕਾਫੀ ਦੂਰੋਂ ਦੂਰੋਂ ਲੋਕ ਉੱਥੇ ਦੇਖਣ ਲਈ ਕਿਸ਼ਤੀਆਂ ਦੇ ਵਿੱਚ ਘੁੰਮ ਕੇ ਜਾਂਦੇ ਹਨ ਇੱਥੇ ਨਦੀਆਂ ਵੀ ਚੰ ਅ ਕਾਫੀ ਪਹਾੜਾਂ ਕਰਕੇ ਨਦੀਆਂ ਵੀ ਨਿਕਲਦੀਆਂ ਹਨ ਅਤੇ ਘਰ ਦ ਅ ਘਰੋਂ ਨੇੜੇ ਕਈ ਜਗ੍ਹਾ 'ਤੇ ਬਹੁਤ ਚੰਗੇ ਚੰਗੇ ਪਾਰਕ ਬਣਾਏ ਹੋਏ ਹਨ ਜਿਨ੍ਹਾਂ ਦੇ ਵਿੱਚ ਲੋਕ ਸਵੇਰੇ ਸ਼ਾਮ ਘੁੰਮ ਕੇ ਆਉਂਦੇ ਹਨ ਨੇੜੇ ਤੇੜੇ ਹੋਰ ਵੀ ਇੱਕ ਸ਼ਹਿਰ ਵੀ ਹ ਕਾਫੀ ਚੰਡੀਗੜ੍ਹ ਵਿੱਚ ਵੀ ਬਹੁਤ ਚੰਗੇ ਚੰਗੇ ਪਾਰਕ ਹਨ ਜਿਨ੍ਹਾਂ ਦੇ ਵਿੱਚ ਲੋਕ ਬੜੇ ਆਰਾਮ ਨਾਲ ਘੁੰਮ ਕੇ ਬੜੇ ਖੁਸ਼ ਹੁੰਦੇ ਹਨ ਕਾਫੀ ਇ ਇੱਥੇ ਜੰਗਲ ਦੇ ਵਿੱਚ ਕਾਫੀ ਤਰ੍ਹਾਂ ਦੇ ਜਾਨਵਰ ਵੀ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਮੋਰ ਵਗੈਰਾ ਹੋਰ ਵੀ ਕਾਫੀ ਤਰ੍ਹਾਂ ਦੀਆਂ ਅਤੇ ਜੰਗਲ ਦੇ ਵਿੱਚ ਦਰੱਖਤ ਵਗੈਰਾ ਵੀ ਕਾਫੀ ਲੋਕ ਦੇਖਣ ਲਈ ਜਾਂਦੇ ਹਨ ਅਤੇ ਨਦੀਆਂ ਦੇ ਵਿੱਚ ਵੀ ਚੰਗੇ ਚੰਗੇ ਸੋ ਰੇਤ ਵਗੈਰਾ ਲੈ ਕੇ ਲੋਕ ਆਪਣੇ ਘਰਾਂ ਦੀ ਮੁਰੰਮਤ ਲਈ ਲੈ ਕੇ ਆਉਂਦੇ ਹਨ